ਹਾਂਜੀ ਮੈਂ ਇੱਕ ਲਾਈਵ ਮੋਡਲ ਬਣਾਇਆ ਹੈ ਮੈਂ ਵੋ ਉਹ ਗੂਗਲ ਤੋਂ ਦੇਖਿਆ ਸੀਗਾ ਅਤੇ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਅਤੇ ਮੇਰੇ ਮਨ ਦੇ ਵਿੱਚ ਇੱਛਾ ਜਾਗੀ ਕਿ ਮੈਂ ਵੀ ਇਸਨੂੰ ਬਣਾਵਾਂ ਅਤੇ ਉਹ ਸੀਗਾ ਕਿ ਨਾ ਇੱਕ ਚੰਦ ਸੀਗਾ ਚੰਦ ਦੇ ਉੱਤੇ ਇੱਕ ਕੁੜੀ ਬੈਠੀ ਹੋਈ ਸੀਗੀ ਅਤੇ ਮਤਲਬ ਕਿ ਮੈਂ ਉਸਨੂੰ ਮੈਨੂੰ ਨਾ ਫੇਸ ਨਹੀਂ ਬਣਾਉਣਾ ਆਉਂਦਾ ਸੀਗਾ ਅਤੇ ਪਹਿਲਾਂ ਮੈਂ ਸ਼ੁਰੂ ਸ਼ੁਰੂ ਵਿੱਚ ਬਣਾਇਆ ਅਤੇ ਮੈਨੂੰ ਠੀਕ ਨਹੀਂ ਲੱਗਿਆ ਮਤਲਬ ਤਾਂ ਮੈਂ ਹੌਲ਼ੀ ਹੌਲ਼ੀ ਮਤਲਬ ਇੱਕ ਵਾਰੀ ਉਹਨੂੰ ਬਣਾਇਆ ਦੋ ਵਾਰੀ ਬਣਾਇਆ ਤਿੰਨ ਵਾਰੀ ਬਣਾਇਆ ਮਤਲਬ ਫਿਰ ਮੈਂ ਬਣਾਈ ਗਈ ਤਾਂ ਮੈਨੂੰ ਮਤਲਬ ਆਖਰ ਦੇ ਵਿੱਚ ਮੈਨ ਮੇਰੀ ਮਿਹਨਤ ਦਾ ਫ਼ਲ ਮੈਨੂੰ ਮਿਲ ਗਿਆ ਮੈਂ ਬਹੁਤ ਸੋਹਣਾ ਬਣਾਇਆ ਉਸਨੂੰ ਅਤੇ ਮੈਂ ਉਸਨੂੰ ਆਪਣੇ ਜਿਹੜੇ ਸਟੂਡੈਂਟਸ ਆ ਟਿਊਸ਼ਨ ਰੱਖੇ ਹੋਏ ਬੱਚੇ ਮੈਂ ਉਹਨਾਂ ਨੂੰ ਵੀ ਦਿਖਾਇਆ ਅਤੇ ਉਹਨਾਂ ਨੂੰ ਵੀ ਬਹੁਤ ਪਸੰਦ ਆਇਆ ਅਤੇ ਮੈਂ ਉਸਨੂੰ ਜਿਹੜਾ ਆਪਣਾ ਇੰਸਟਾਗ੍ਰਾਮ ਪੇਜ਼ ਹੈ ਉਸ 'ਤੇ ਵੀ ਪਾਇਆ ਹੋਇਆ ਹੈ ਉਸ 'ਤੇ ਵੀ ਮੈਨੂੰ ਬਹੁਤ ਸਾਰੇ ਲਾਇਕ ਆਏ ਆ ਬਹੁਤ ਸਾਰੇ ਕਮੈਂਟਸ ਆਏ ਹੈ ਠੀਕ ਹੈ ਉਸ ਤੋਂ ਬਾਅਦ ਮੈਂ ਫਿਰ ਮੈਂ ਹੌਲ਼ੀ ਹੌਲ਼ੀ ਬ ਹੋਰ ਵੀ ਬਹੁਤ ਸਾਰੇ ਚਿੱਤਰ ਬਣਾਏ ਹੋਏ ਨੇ ਯੂਟਿਊਬ ਜਾਂ ਉਸ ਤੋਂ ਇੰਸਟਾ ਤੋਂ ਦੇਖ ਕੇ ਜਾਂ ਗੂਗਲ ਤੋਂ ਦੇਖ ਕੇ